ਹੈਲੋ ਹਾਂਜੀ ਹਾਂਜੀ ਵੀਰ ਜੀ ਹਾਂਜੀ ਹਾਂਜੀ ਦੱਸੋ ਜੀ ਅੱਛਾ ਬਣਾ ਬਣਾਇਆ ਮਕਾਨ ਖਰੀਦਣਾ ਕਿ ਪਲਾਟ ਖਰੀਦਣਾ ਅੱਛਾ ਠੀਕ ਹੈ ਕੀ ਰਿਕੁਆਇਰਮੈਂਟ ਨੇ ਤੁਹਾਡੀਆਂ ਕੀ ਕੁਛ ਦੇ ਦੇਖਣਾ ਚਾਹੁੰਦੇ ਹੋ ਕੀ ਠੀਕ ਹੈ ਜੀ ਅੱਛਾ ਜੀ ਓਕੇ ਓਕੇ ਕੋਈ ਨਹੀਂ ਪਲਾਟ ਤਾਂ ਪ ਆਪਣੇ ਕੋਲ ਮਕਾਨ ਦਾ ਬਹੁਤ ਨੇ ਬਾਕੀ ਚਾਰ ਵਿਸਵਿਆਂ 'ਚ ਮਿਲ ਜੂਗਾ ਸਿੰਗਲ ਸਟੋਰੀ ਅ ਬਜਟ ਬੁਜਟ ਕੀ ਆ ਤੁਹਾਡਾ ਅੰਦਾਜ਼ਾ ਵੀਹ ਪੱਚੀ ਲੱਖ ਫਿਰ ਤੁਹਾਨੂੰ ਇੱਕ ਤਾਂ ਪੁਰਾਣੇ ਜਿਹੜੇ ਆਪਣੇ ਮਤਲਬ ਸ਼ਹਿਰ ਦੇ ਵਿੱਚ ਨੇ ਹੈ ਨਾ ਉੱਥੇ ਵੀ ਮਿਲ ਜੂਗਾ ਜਾਂ ਤੁਸੀਂ ਇਹ ਵੀ ਸ਼ਹਿਰ ਤੋਂ ਬਾਹਰ ਜਿਹੜੇ ਕਲੋਨੀ ਕੱਟਦੇ ਨੇ ਉਹਨਾਂ 'ਚ ਦੇਖਣਾ ਅੱਛਾ ਫਿਰ ਤੁਹਾਨੂੰ ਫਾਟਕ ਫੂਟਕ ਦੀ ਸਮੱਸਿਆ ਕਿਵੇਂ ਆ ਗੱਡੀ ਗੁੱਡੀ ਦਾ ਅੱਛਾ ਅੱਛਾ ਦਿਖਾ ਦਿੰਦੇ ਹਾਂ ਨਗਰ 'ਚ ਪਏ ਨੇ ਆਪਣੇ ਕੋਲ ਮਕਾਨ ਦੋ ਮਕਾਨ ਨੇ ਉੱਥੇ ਚਾਰ ਵਿਸਵੇ 'ਚ ਹੀ ਬਣੇ ਹੋਣਗੇ ਲਗਭਗ ਡਿਮਾਂਡ ਤਾਂ ਬਸ ਬ ਮੈਚ ਕਰੀ ਜਾਊਗਾ ਆਪਣਾ ਜਿੰਨਾ ਤੁਸੀਂ ਕਹਿੰਦੇ ਹੋ ਵੀਹ ਤੋਂ ਪੱਚੀ ਲੱਖ ਚੱਲ ਥੋੜ੍ਹਾ ਮੋਟਾ ਫਰਕ ਹੋਵੇਗਾ ਉਨਾ ਆਪਾਂ ਸਮਾਨ ਪੁੱਛ ਲਾਂਗੇ ਸੀਵਰੇਜ ਪਿਆ ਵਾ ਪਿਆ ਵਾ ਸੀਵਰੇਜ ਸਟ੍ਰੀਟ ਲਾਈਟ ਲੱਗੀ ਹੈ ਟੂਟੀ ਦਾ ਮਤਲਬ ਕਨੈਕਸ਼ਨ ਵੀ ਪਿਆ ਵਾ ਸਰਕਾਰੀ ਦਾ ਉਹ ਵੀ ਮਤਲਬ ਸਹੂਲਤ ਹੈਗੀ ਆ ਸਾਰੀ ਅਤੇ ਸੜਕ ਬਣੀ ਹੋਈ ਆ ਠੀਕ ਆ ਚਾਰ ਕੁ ਵਿਸਵੇ ਦਾ ਪਲਾਟ ਆ ਸੜਕ ਇੰਟਰਲੋਕ ਬਣੀ ਟਾਈਲਾਂ ਟਾਈਲਾਂ ਦੀ ਵੀਹ ਫੁੱਟ ਗਲੀ ਆ ਹਾਂ ਜੇ ਵੀਹ ਫੁੱਟ ਗਲੀ ਤੱਕ ਤਾਂ ਦੇਖੋ ਇੰਟਰਲੋਕ ਹੀ ਪੈਂਦੀ ਹੈ ਜੇ ਵੀਹ ਫੁੱਟ ਤੋਂ ਵੱਧ ਗਲੀ ਦੀ ਚੌੜਾਈ ਫਿਰ ਉਹ ਮਤਲਬ ਸੜਕ ਬਣਾ ਦਿੰਦੇ ਨੇ ਵੀਹ ਫੁੱਟ ਚੌੜੀ ਗਈ ਹੈ ਚੜਦੇ ਪਾਸੇ ਨੂੰ ਮੂੰਹ ਆ ਉਹਦਾ ਪਲਾਟ ਮਕਾਨ ਦਾ ਅਤੇ ਬੰਦੇ ਸ਼ਿਫਟ ਕਰ ਗਏ ਬਾਹਰ ਚਲੇ ਗਏ ਪਹਿਲਾਂ ਰਿਹਾਇਸ਼ ਸੀ ਪਹਿਲਾਂ ਬੱਚੇ ਬਾਹਰ ਚਲੇ ਗਏ ਉਸ ਤੋਂ ਬਾਅਦ ਉਹ ਆਪ ਵੀ ਹੁਣ ਉਹਨਾਂ ਨੇ ਸੇਲ 'ਤੇ ਹੀ ਲਾਇਆ ਹੋਇਆ ਠੀਕ ਹੈ ਅਤੇ ਆਪ ਬਣਾਇਆ ਵਿਆ ਆਪ ਬਣਾਇਆ ਵਿਆ ਬਣਾਇਆ ਸੀ ਦੋ ਹਜ਼ਾਰ ਐਂ ਮੰਨੋ ਵੀ ਸੱਤ ਅੱਠ ਦੇ ਵਿੱਚ ਕੰਪਲੀਟ ਕੀਤਾ ਸੀ ਹਾਂ ਕੋਈ ਗੱਲ ਨਹੀਂ ਮੈਂ ਹੁੰਦਾ ਦੁਕਾਨ 'ਤੇ ਤੁਸੀਂ ਐਂ ਕਰੋ ਨਾ ਫਿਰ ਤੁਸੀਂ ਮੈਨੂੰ ਟਾਈਮ ਦੇ ਦਿਓ ਕਿਉਂਕਿ ਫਿਰ ਮੈਂ ਉਹਨਾਂ ਦਾ ਕੋਈ ਨਾ ਰਿਸ਼ਤੇਦਾਰ ਰਹਿੰਦੇ ਨੇ ਇੱਥੇ ਅਤੇ ਉਹਨਾਂ ਨੂੰ ਚਾਬੀਆਂ ਵਗੈਰਾ ਉਹਨਾਂ ਨੇ ਫੜਾਈਆਂ ਵੀਆਂ ਨੇ ਉਹਨਾਂ ਤੋਂ ਲੈ ਕੇ ਤੁਹਾਨੂੰ ਮੈਂ ਹਾਂ ਫੋਨ ਕਰਕੇ ਤੁਸੀਂ ਮੈਨੂੰ ਜ਼ਰੂਰ ਆਇਓ ਅਤੇ ਜੇ ਕੋਈ ਤੁਹਾਡਾ ਮਿੱਤਰ ਪਿਆਰਾ ਹੋਰ ਦਿਖਾਉਣਾ ਦਖੂਣਾ ਕਿਸੇ ਨੂੰ ਚਾਹੇ ਨਾਲ ਲੈ ਆਇਓ ਰਾਏ ਮਸ਼ਵਰਾ ਕਰਨਾ ਹੁੰਦਾ ਹੈ ਨਾ ਓਕੇ ਜੀ ਕੋਈ ਨਾ ਆ ਜਿਓ ਤੁਸੀਂ ਜਦੋਂ ਮਰਜ਼ੀ ਓਕੇ ਜੀ